ਘਰ ਦੀ ਰਸੋਈ ਘਰ ਵਿੱਚ ਪਿਆਰ ਅਤੇ ਪਰਿਵਾਰਕ ਸਾਂਝ ਦਾ ਪ੍ਰਤੀਕ ਮੰਨੀ ਜਾਂਦੀ ਹੈ ਭੋਜਨ ਬਣਾਉਣ ਤੋਂ ਲੈ ਕੇ ਖਾਣ ਤੱਕ ਦੇ ਸਫਰ ਵਿੱਚ ਪਰਿਵਾਰ ਪ੍ਰਤੀ ਪਿਆਰ ਦਾ ਹੀ ਸਫਰ ਹੁੰਦਾ ਹੈ ਪਰ ਜੇਕਰ ਘਰ ਦਾ ਹਰ ਜੀਅ ਰਸੋਈ ਦੇ ਕੰਮ ਵਿੱਚ ਸਵਾਣੀ ਦਾ ਸਾਥ ਦੇਵੇ ਤਾਂ ਇਹ ਪਿਆਰ ਦੂਣਾ ਹੋ ਜਾਂਦਾ ਹੈ ਜੇਕਰ ਸਾਰੇ ਜੀਅ ਘਰ ਦੀ ਰਸੋਈ ਅਤੇ ਘਰ ਦੇ ਬਾਕੀ ਕੰਮ ਵੀ ਰਲ ਕੇ ਕਰਨ ਤਾਂ ਘਰ ਦਾ ਕੰਮ ਜਲਦੀ ਨਿਬੜੇਗਾ ਅਤੇ ਪਰਿਵਾਰ ਨੂੰ ਇੱਕ ਦੂਜੇ ਨਾਲ ਸਮਾਂ ਬਿਤਾਉਣ ਅਤੇ ਵਿਚਾਰ ਸਾਂਝੇ ਕਰਨ ਦਾ ਵੀ ਮੌਕਾ ਮਿਲਦਾ ਹੈ ਜਿਵੇਂ ਜੇਕਰ ਇੱਕ ਜੀਅ ਰੋਟੀ ਬਣਾ ਰਿਹਾ ਹੈ ਤਾਂ ਦੂਜਾ ਸਬਜ਼ੀ ਬਣਾ ਸਕਦਾ ਹੈ ਜੇ ਇੱਕ ਜੀਅ ਬਰਤਨ ਧੋ ਰਿਹਾ ਹੈ ਤਾਂ ਦੂਜਾ ਘਰ ਦੇ ਬਾਕੀ ਜੀਆਂ ਨੂੰ ਭੋਜਨ ਫੜਾ ਸਕਦਾ ਹੈ ਇਸ ਨਾਲ ਅਸੀਂ ਪਰਿਵਾਰ ਦੇ ਸਾਰੇ ਜੀਅ ਹੋਰ ਨੇੜੇ ਆ ਜਾਂਦੇ ਹਾਂ ਘਰ ਦੀਆਂ ਸਵਾਣੀਆਂ ਨੂੰ ਵੀ ਇਸ ਨਾਲ ਆਪਣੇ ਮਨ ਦੀਆਂ ਉਲਝਣਾਂ ਨੂੰ ਸਾਂਝਾ ਕਰਨ ਦਾ ਸਮਾਂ ਮਿਲ ਜਾਂਦਾ ਹੈ ਅਤੇ ਘਰ ਤੋਂ ਬਾਹਰ ਕੰਮ ਕਰਦੇ ਜੀਆਂ ਨੂੰ ਵੀ ਪਰਿਵਾਰ ਨਾਲ ਆਪਣੀਆਂ ਮਾਨਸਿਕ ਪਰੇਸ਼ਾਨੀਆਂ ਸਾਂਝਾ ਕਰਨ ਦਾ ਮੌਕਾ ਮਿਲ ਜਾਂਦਾ ਹੈ